ਸਾਡੇ ਖੇਤਰ ਵਿੱਚ ਸਿੱਖ ਧਾਰਮਿਕ ਸੰਸਥਾਵਾਂ ਪ੍ਰਮੁੱਖ ਅਤੇ ਹਿੰਦੂ ਮੰਦਰ ਅਤੇ ਮੁਸਲਮਾਨਾਂ ਦੀ ਮਸਜਿਦਾਂ ਦਾ ਦੀ ਰੀਤੀ ਰਿਵਾਜਾਂ ਦੀ ਐਨ ਪਾਲਣਾ ਕੀਤੀ ਜਾਂਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਹਰੇਕ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਂਦਾ ਰਲ ਮਿਲਕੇ ਮਨਾਇਆ ਜਾਂਦਾ ਹੈ ਇਹ ਇੱਕ ਭਾਈਚਾਰਕ ਸਾਂਝ ਦਾ ਮਤਲਬ ਸਾਂਝ ਹੁੰਦੀ ਹੈ ਜਿਸਨੂੰ ਹਰੇਕ ਆਪਣੇ ਫਰਜ਼ ਸਮਝ ਕੇ ਨਿਭਾਉਂਦਾ ਹੈ ਹਿੰਦੂ ਸਿੱਖ ਮੁਸਲਮਾਨ ਈਸਾਈ ਐਨ ਮਿਲਜੁਲ ਕੇ ਰਹਿੰਦੇ ਹਨ ਇਹ ਆਪਣੀਆਂ ਸਾਰੀਆਂ ਧਾਰਮਿਕ ਰੀਤੀ ਰਿਵਾਜਾਂ ਨੂੰ ਐਨ ਚੰਗੀ ਤਰ੍ਹਾਂ ਪਾਲਣਾ ਕਰਦੇ ਹਨ ਮੰਨਦੇ ਹਨ ਹਰੇਕ ਧਰਮ ਦਾ ਹਰੇਕ ਵਿਅਕਤੀ ਕੌਮ ਦਾ ਬੰਦਾ ਸਤਿਕਾਰ ਕਰਦਾ ਹੈ ਜੋ ਕਿ ਸਾਨੂੰ ਕਰਨਾ ਵੀ ਚਾਹੀਦਾ ਹੈ ਹਰੇਕ ਧਰਮ ਕੋਈ ਮਾੜਾ ਨਹੀਂ ਹੁੰਦਾ ਹਰੇਕ ਧਰਮ ਚੰਗਾ ਹੁੰਦਾ ਹੈ ਜਿਹਦੀ ਸਾਨੂੰ ਚੰਗੀ ਤਰ੍ਹਾਂ ਐਨ ਵਧੀਆ ਤਰੀਕੇ ਨਾਲ਼ ਆਪਣੇ ਦਿਲੋਂ ਮੰਨਣ ਦੀ ਤਮੰਨਾ ਚਾਹੀਦੀ ਹੈ ਸਾਡੇ ਇੱਥੇ ਬਹੁਤ ਸਾਰੇ ਮੇਲੇ ਕੁਰਾਲੀ ਸ਼ਹਿਰ ਵਿੱਚ ਲੱਗਦੇ ਮਾਤਾ ਰਾਣੀ ਦਾ ਮੇਲਾ ਗੁਸਾਈਂ ਵਾਲਾ ਮੇਲਾ ਆਪਣੇ ਬਿੰਦਰੱਖ ਲੋਹੜੀ ਵੇਲੇ ਮੇਲਾ ਲੱਗਦਾ ਹੈ ਉਹ ਸਿੱਖਾਂ ਦਾ ਬਹੁਤ ਧਾਰਮਿਕ ਸਥਾਨ ਹੈ ਆਪਣੇ ਲਾਗ ਭੱਠਾ ਸਾਹਿਬ ਗੁਰਦੁਆਰਾ ਸਾਹਿਬ ਹੈ ਜੋ ਕਿ ਸਿੱਖਾਂ ਦਾ ਇੱਕ ਸਿਰਮੋਰ ਅਸ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਆਪਣੇ ਲਾਗ ਇੱਕ ਮੁਸਲਮਾਨਾਂ ਦੀ ਮਸਜਿਦ ਹੈ ਮਾਣਕਪੁਰ ਸ਼ਰੀਫ਼ ਉੱਥੇ ਮੁਸਲਮਾਨ ਆਏ ਸਾਲ ਆਪਣਾ ਧੂਮ ਧਾਮ ਨਾਲ ਤਿਉਹਾਰ ਮਨਾਇਆ ਜਾਂਦਾ ਹੈ